ਵੈਸੇ ਤਾਂ ਮੈਨੂੰ ਜਿਹੜੇ ਪੰਜਾਬੀ ਖਾਣੇ ਆ ਉਹ ਜ਼ਿਆਦਾ ਪਸੰਦ ਹੈ ਬਟ ਅੱਜ ਕੱਲ੍ਹ ਜਿਹੜੇ ਬੱਚੇ ਆ ਨਾ ਉਹ ਥੋੜ੍ਹਾ ਜਿਹਾ ਇਟੈਲੀਅਨ ਔਰ ਇਹ ਸਾਰਾ ਖਾਣਾ ਪਸੰਦ ਕਰਦੇ ਆ ਪਿੱਜ਼ਾ ਪਾਸਤਾ ਉਹਨਾਂ ਨੂੰ ਪਸੰਦ ਹੈ ਅਤੇ ਮੇਰੀ ਬੇਟੀ ਨੂੰ ਵੀ ਜਿਹੜਾ ਪਿੱਜ਼ਾ ਹੈ ਬਹੁਤ ਪਸੰਦ ਹੈ ਅਤੇ ਉਹ ਕਈ ਵਾਰ ਬਹੁਤ ਜਿੱਦ ਕਰਦੀ ਆ ਮੰਮਾ ਆਪਾਂ ਪਿੱਜ਼ਾ ਬੇਸ ਲਿਆਉਂਦੇ ਹਾਂ ਹੈ ਨਾ ਆਪਾਂ ਪਿੱਜ਼ਾ ਬਣਾਉਂਦੇ ਹਾਂ ਬਟ ਮੈਨੂੰ ਐਂ ਹੁੰਦਾ ਆ ਵੀ ਜਿਹੜਾ ਪਿੱਜ਼ਾ ਬੇਸ ਬਣਿਆ ਬਣਾਇਆ ਆਪਾਂ ਬਜ਼ਾਰੋਂ ਲੈ ਕੇ ਆਉਂਦੇ ਹਾਂ ਹੈ ਨਾ ਉਹ ਇੰਨਾਂ ਹੈਲਦੀ ਨਹੀਂ ਹੁੰਦਾ ਅਤੇ ਪਤਾ ਨਹੀਂ ਕਦੋਂ ਦਾ ਬਣਿਆ ਹੁੰਦਾ ਆ ਉਹਦੇ ਵਿੱਚ ਕੀ ਕੀ ਹੋਰ ਜਿਹੜੇ ਕੈਮੀਕਲਸ ਵੀ ਕੁਛ ਪਾਏ ਹੁੰਦੇ ਅੱਜ ਕੱਲ੍ਹ ਅਤੇ ਇਸ ਲਈ ਫਿਰ ਮੈਂ ਸੋਚਿਆ ਕਿ ਮੈਂ ਯੂਟਿਊਬ ਮੈਂ ਆਪਣੀ ਖੋਲ੍ਹੀ ਅਤੇ ਮੈਂ ਚੈੱਕ ਕੀਤਾ ਵੀ ਪਿੱਜ਼ਾ ਬੇਸ ਕਿਵੇਂ ਬਣਾਉਣਾ ਆ ਅਤੇ ਇਹ ਮੈਂ ਕੀਤਾ ਕਰੋਨਾ ਟਾਈਮ 'ਤੇ ਜਦੋਂ ਆਪਾਂ ਬਿਲਕੁਲ ਵੇਹਲੇ ਸੀਗੇ ਅਤੇ ਮੈਂ ਫਿਰ ਉਸ ਟਾਈਮ ਪਿੱਜ਼ਾ ਬੇਸ ਖੁਦ ਹੀ ਬਣਾਇਆ ਮੈਂ ਸਾਰੇ ਇੰਗਰੀਡੀਅੰਟਸ ਜਿਹੜੇ ਸੀਗੇ ਉਹ ਚੈੱਕ ਕੀਤੇ ਅਤੇ ਮੈਂ ਮੰਗਵਾਏ ਅਤੇ ਮੈਂ ਉਹ ਪਿੱਜ਼ਾ ਬੇਸ ਖੁਦ ਤਿਆਰ ਕੀਤਾ ਅਤੇ ਮੈਂ ਮੈਨੂੰ ਪ੍ਰੇਰਨਾ ਇਹ ਪਿੱਜ਼ਾ ਬੇਸ ਬਣਾਉਣ ਦੀ ਇਸ ਲਈ ਮਿਲੀ ਕਿਉਂਕਿ ਜਿਹੜੀਆਂ ਆਪਾਂ ਬਣੀਆਂ ਬਣਾਈਆਂ ਚੀਜ਼ਾਂ ਹਮੇਸ਼ਾਂ ਖਰੀਦ ਲੈਂਦੇ ਹਾਂ ਹੈ ਨਾ ਉਹ ਕਿਤੇ ਨਾ ਕਿਤੇ ਜਾ ਕੇ ਕੁਛ ਨਾ ਕੁਛ ਉਹਨਾਂ ਦੇ ਵਿੱਚ ਕੁਛ ਗਲਤ ਹੁੰਦਾ ਹੀ ਹੁੰਦਾ ਆ ਇਸ ਲਈ ਜਿਹੜੀ ਚੀਜ਼ ਤੁਸੀਂ ਆਪਣੇ ਹੱਥੀਂ ਬਣਾ ਰਹੇ ਹੋ ਆਪਣੇ ਹੱਥੀਂ ਬਣਾ ਕੇ ਆਪਣੇ ਬੱਚੇ ਨੂੰ ਦੇ ਰਹੇ ਹੋ ਨਾ ਉਹ ਉਹਦੀ ਸਿਹਤ ਦੇ ਲਈ ਵੀ ਸਭ ਤੋਂ ਵਧੀਆ ਹੈ ਅਤੇ ਉਹ ਵੈਸੇ ਵੀ ਸਵਾਦ ਲੱਗਦੀ ਹੈ ਚੀਜ਼ ਅਤੇ ਇਸ ਲਈ ਮੈਂ ਜਿਹੜਾ ਪਿੱਜ਼ਾ ਬੇਸ ਵੀ ਖੁਦ ਬਣਾਇਆ ਅਤੇ ਉੱਪਰ ਸਾਰੀਆਂ ਸਬਜ਼ੀਆਂ ਵਗੈਰਾ ਪਾ ਕੇ ਅਤੇ ਮੈਂ ਜਿਹੜੀ ਉੱਤੇ ਮੈਨੀਜ਼ ਪੈਂਦੀ ਆ ਮੈਂ ਉਹ ਵੀ ਖੁਦ ਬਣਾਈ ਨੈਟ ਤੋਂ ਦੇਖ ਕੇ ਬਿਲਕੁਲ ਸਿੰਪਲ ਤਰੀਕੇ ਦੇ ਨਾਲ